ਸਰਕਾਰ ਵੱਲੋਂ ਸਾਡੀ ਭਾਈਚਾਰੇ ਵਿੱਚ ਬਿਮਾਰੀਆਂ ਦੀ ਜਾਗਰੂਕਤਾ ਦੇਣ ਲਈ ਸਮੇਂ ਸਮੇਂ 'ਤੇ ਕਾਫੀ ਪ੍ਰੋਗਰਾਮ ਚਲਾਉਂਦੀ ਹੈ ਜਿਹਦੇ ਵਿੱਚ ਲੋਕਾਂ ਨੂੰ ਦੇਖਭਾਲ ਕਰਨ ਅਤੇ ਉਹਨਾਂ ਨੂੰ ਬਿਮਾਰੀਆਂ ਤੋਂ ਬਚਾ ਕੇ ਰੱਖਣ ਲਈ ਉਪਾਅ ਵੀ ਦੱਸਦੀ ਹੈ ਸਰਕਾਰ ਵੱਲੋਂ ਇਹ ਲਗਾਤਾਰ ਹੀ ਉਪਰਾਲੇ ਕੀਤੇ ਜਾ ਰਹੇ ਹਨ ਜੋ ਕਿ ਬਹੁਤ ਵਧੀਆ ਹਨ ਅਤੇ ਇਦਾਂ ਦੇ ਜਿਹੜੇ ਪ੍ਰੋਗਰਾਮ ਹੈਗੇ ਸਰਕਾਰ ਵੱਲੋਂ ਹਮੇਸ਼ਾ ਹੀ ਚੱਲਦੇ ਰੱਖਣੇ ਚਾਹੀਦੇ ਹਨ ਤਾਂ ਜੋ ਸਾਡੇ ਭਾਈਚਾਰੇ ਵਿੱਚ ਜਿਹੜੀ ਬਿਮਾਰੀਆਂ ਹੈਗੀਆਂ ਉਹ ਨਾ ਹੋਣ ਅਤੇ ਹਰ ਇੱਕ ਬੰਦਾ ਆਪਣੀ ਸਿਹਤ ਦੀ ਅੱਛੀ ਸੰਭਾਲ ਕਰ ਸਕੇ